ਸਾਡੇ ਅਨੁਸਾਰ ਮੁੱਖ ਕਾਰਨ ਹਨ ਜੋ ਭੰਗੜਾ ਐਰੋਪਿਕ ਨੂੰ ਸਰੀਰਿਕ ਤੌਰ 'ਤੇ ਚੁਣੌਤੀਪੂਰਨ ਮਜ਼ੇਦਾਰ ਬਣਾਉਂਦੇ ਹਨ ਉਹ ਭੰਗੜਾ ਐਰੋਪਿਕ ਇੱਕ ਤਰ੍ਹਾਂ ਦਾ ਹਾਰਟ ਵਰਕ ਹੈ ਜੋ ਕਿ ਆਪਾਂ ਘਰ ਵੀ ਕਰਦੇ ਹਾਂ ਅਤੇ ਜਿਮ ਜਾ ਕੇ ਵੀ ਕਰ ਸਕਦੇ ਹੈ ਅੱਜ ਕੱਲ੍ਹ ਇਹ ਹਾਈ ਬੀਟ 'ਤੇ ਗਾਣੇ ਲਾ ਕੇ ਜ਼ਿਆਦਾ ਕੀਤਾ ਜਾਂਦਾ ਨੇ ਇਸ ਨੂੰ ਜ਼ਿਆਦਾ ਤੇਜ਼ ਡਾਂਸ ਜ਼ਿਆਦਾ ਹਾਈ ਬੀਟ 'ਤੇ ਗਾਣੇ ਲਾਉਣੇ ਹੈ ਜ਼ਿਆਦਾ ਤੇਜ਼ ਤੇਜ਼ ਗਾਣੇ ਚੱਲਣ ਆਪਣਾ ਹੱਥਾਂ ਪੈਰਾਂ ਦੀ ਮੂਵਮੈਂਟ ਤੇਜ਼ ਤੇਜ਼ ਹੁੰਦੀ ਹੈ ਇਸ ਨਾਲ ਆਪਾਂ ਵੱਖ ਵੱਖ ਤਰ੍ਹਾਂ ਦੇ ਸਟੈੱਪ ਕਰਦੇ ਹੈ ਅਤੇ ਬ ਇਹ ਦੇਸੀ ਬੀਟ 'ਤੇ ਜਦੋਂ ਆਪਾਂ ਗਾਣੇ ਲਾਉਣੇ ਨੇ ਤਾਂ ਆਪਣੇ ਵੱਖ ਵੱਖ ਸਟੈਪ ਹੋਣ ਨਾਲ ਆਪਾਂ ਨੂੰ ਜ਼ਿਆਦਾ ਚੁਣੌਤੀ ਮਿਲਦੀ ਹੈ ਪਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਫੋਨ ਦੇ ਜ਼ਰੀਏ ਲੋਕ ਸੋਸ਼ਲ ਮੀਡੀਆ 'ਤੇ ਯੂਟੀਊਬ 'ਤੇ ਇੰਸਟਾਗ੍ਰਾਮ 'ਤੇ ਕਾਫੀ ਕਾਫੀ ਲੋਕ ਘੰਟਾ ਘੰਟਾ ਦੋ ਦੋ ਘੰਟੇ ਪੂਰੇ ਫਾਸਟ ਤਰੀਕੇ ਨਾਲ ਨਵੇਂ ਨਵੇਂ ਸਟੈਪ ਕਰਕੇ ਆਪਦੇ ਚਿਹਰੇ ਦੇ ਮੂਵਮੈਂਟ ਨੂੰ ਹਿਲਾ ਕੇ ਅੱਖਾਂ ਦੀ ਮੂਵਮੈਂਟ ਨੂੰ ਹਿਲਾ ਕੇ ਅਤੇ ਇਸ ਨੂੰ ਨਵੇਂ ਨਵੇਂ ਸਟੈਪ ਵਿੱਚ ਪਾ ਕੇ ਅਤੇ ਕਰਦੇ ਨੇ ਅੱਜ ਕੱਲ੍ਹ ਦੇ ਲੋਕ ਇਸ ਨੂੰ ਬੜੀ ਚੁਣੌਤੀਪੂਰਨ ਬਣਾਉਂਦੇ ਨੇ ਔਰ ਟਾਈਮਿੰਗ ਰੱਖ ਕੇ ਇਸ ਨੂੰ ਬੜਾ ਲੰਬਾ ਲੈਂਦੇ ਨੇ ਅਤੇ ਕਈ ਤਰ੍ਹਾਂ ਇਹ ਇਹ ਕੀਤਾ ਜਾਂਦਾ ਨੇ